ਹਾਂਜੀ ਕਦੀ ਕਦੀ ਮੈਂ ਆਪਣੀ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਅ ਤਸਵੀਰਾਂ ਪੋਸਟ ਕਰਦੀ ਹਾਂ ਉਹ ਵੀ ਜਦੋਂ ਕੋਈ ਘਰ 'ਚ ਕੋਈ ਫੰਕਸ਼ਨ ਵਗੈਰਾ ਹੋਇਆ ਹੋਵੇ ਤਾਂ ਆਪਣੀ ਜਿਹੜੀ ਸਾਡੇ ਦੂਰ ਬੈਠੇ ਰਿਸ਼ਤੇਦਾਰ ਦੋਸਤ ਮਿੱਤਰ ਹੈ ਵੀ ਜਿਹੜੇ ਨਹੀਂ ਆ ਸਕੇ ਸਾਡੇ ਫੰਕਸ਼ਨ ਦੇ ਵਿੱਚ ਨਹੀਂ ਪਹੁੰਚ ਸਕੇ ਸੋ ਉਹਨਾਂ ਦੇ ਨਾਲ਼ ਸ਼ੇਅਰ ਕਰਨ ਦੇ ਲਈ ਉਹਨੂੰ ਮੈਂ ਵੱਟਸਅੱਪ 'ਤੇ ਵੀ ਸ਼ੇਅਰ ਕਰ ਸਕਦੀ ਹਾਂ ਸ ਸਟੋਰੀ ਅਪਡੇਟਸ ਯਾਂ ਫੇਸਬੁੱਕ 'ਤੇ ਜਾਂ ਇੰਸਟਾ 'ਤੇ ਸ਼ੇਅਰ ਕਰਦੀ ਹਾਂ ਇਹ ਫੋਟੋਆਂ ਅਤੇ ਬਸ ਇਹਦਾ ਇੱਕ ਹੀ ਫਾਇਦਾ ਇੱਕ ਤਾਂ ਉਹ ਮਤਲਬ ਤੁਹਾਡੀਆਂ ਮੈਮਰੀ ਸੇਵ ਹੋ ਜਾਂਦੀਆਂ ਮੰਨ ਲਓ ਅਸੀਂ ਕਿਤੇ ਘੁੰਮ ਕੇ ਆਏ ਹਾਂ ਤਾਂ ਉਹ ਫੋਟੋ ਖਿੱਚੀਆਂ ਹੈਗੀਆਂ ਸੋ ਸਾਡੀਆਂ ਮੈਮਰੀਜ਼ ਸੇਵ ਆ ਅਤੇ ਜੇ ਸੋਸ਼ਲ ਮੀਡੀਆ 'ਤੇ ਅਸੀਂ ਉਹ ਟੂਰ ਦੀਆਂ ਫੋਟੋਸ ਪਾਉਣੇ ਆ ਅਤੇ ਕਈ ਇੰਸਪਾਇਰ ਹੁੰਦੇ ਆ ਹੈ ਨਾ ਉਹ ਵੀ ਪ੍ਰੋਗਰਾਮ ਬਣਾ ਲੈਂਦੇ ਆ ਘੁੰਮਣ ਫਿਰਨ ਦਾ ਜਿਹੜਾ ਜਿਨਾਂ ਨੇ ਉਹਨਾਂ ਨੂੰ ਨਵੀਂ ਜਗ੍ਹਾ ਦਾ ਕਿਸੇ ਨੂੰ ਪਤਾ ਲੱਗਦਾ ਕਿ ਵਧੀਆ ਹੈਗਾ ਤਾਂ ਉਹ ਵੀ ਮਤਲਬ ਇੰਜੋਏ ਕਰਦੇ ਇਸ ਚੀਜ਼ ਨੂੰ ਅਤੇ ਦੂਸਰਾ ਹੈਗਾ ਕਿ ਜਿਵੇਂ ਰਿਸ਼ਤੇਦਾਰਾਂ ਨੂੰ ਲਵ ਸ਼ੇਅਰ ਹੋ ਜਾਨੀ ਆ ਫੋਟੋਆਂ ਹੈ ਨਾ ਸੋ ਸਾਡੇ ਕਰਕੇ ਕੀ ਫੰਕਸ਼ਨ ਹੋਇਆ ਜਾਂ ਕੀ ਹੋਇਆ ਇਹਦੇ ਨਾਲ਼ ਬਣਿਆ ਰਹਿੰਦਾ ਨੇੜਤਾ ਕਿਉਂਕਿ ਜਦੋਂ ਕੋਈ ਫਿਰ ਫੋਟੋ ਸਾਡੀ ਲਾਈਕ ਵਗੈਰਾ ਕਰਦੇ ਆ ਜਾਂ ਕੀ ਹੈ ਚੰਗਾ ਲੱਗਦਾ ਸਾਨੂੰ ਵੀ ਹੈ ਨਾ ਕਿਉਂਕਿ ਅਸੀਂ ਕੁਝ ਅਚੀਵ ਕੀਤਾ ਹੁੰਦਾ ਏ ਆ ਘਰੇ ਕੋਈ ਫੰਕਸ਼ਨ ਹੋਇਆ ਉਹ ਵੀ ਸਾਡੀ ਅਚੀਵਮੈਂਟ ਆ ਅਸੀਂ ਟੂਰ 'ਤੇ ਗਏ ਹਾਂ ਤਾਂ ਉਹ ਵੀ ਸਾਡੀ ਕੋਈ ਅਚੀਵਮੈਂਟ ਆ ਸਾਡੇ ਮੈਮਰੇਬਲ ਪਲ ਹੁੰਦੇ ਆਏ ਅਸੀਂ ਇੰਜੋਏ ਕੀਤਾ ਹੁੰਦਾ ਜਿਹੜੀ ਚੀਜ਼ਾਂ ਨੂੰ ਸੋ ਲੋਂਗ ਟਾਈਮ ਲਈ ਅਸੀਂ ਇਹਨਾਂ ਨੂੰ ਸੋਸ਼ਲ ਮੀਡੀਆ 'ਤੇ ਅਸੀਂ ਸੇਵ ਕਰਕੇ ਰੱਖ ਸਕਦੇ ਹਾਂ ਸੋ ਮੈਨੂੰ ਪਸੰਦ ਹੈ ਕਿ ਮੈਂ ਅਕਸਰ ਇਹ ਚੀਜ਼ ਕਦੀ ਕਦੀ ਇਹ ਆਪਣੀਆਂ ਫੋਟੋਆਂ ਵੱਟਸਅੱਪ ਫੇਸਬੁੱਕ 'ਤੇ ਜਾਂ ਇੰਸਟਾ 'ਤੇ ਪਾਉਂਦੀ ਰਹਿੰਦੀ ਹਾਂ